ਵੈਸੇ ਤਾਂ ਘੁੰਮਣ ਲਈ ਸਾਰੇ ਹੀ ਮੌਸਮ ਚੰਗੇ ਹੁੰਦੇ ਨੇ ਮੈਨੂੰ ਬਸੰਤ ਦਾ ਮੌਸਮ ਗਰਮੀਆਂ ਸਰਦੀਆਂ ਬਾਰਿਸ਼ਾਂ ਵਿੱਚੋਂ ਜ਼ਿਆਦਾ ਪਸੰਦ ਹੈ ਗਰਮੀਆਂ ਦੇ ਮੌਸਮ ਵਿੱਚ ਸਾਰਿਆਂ ਦੀ ਛੁੱਟੀਆਂ ਹੁੰਦੀਆਂ ਨੇ ਹਰ ਪਾਸੇ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਬੰਦੇ ਨੂੰ ਟ੍ਰੈਫਿਕ ਜਾਮ ਰਹਿਣ ਦੀ ਦਿੱਕਤ ਅਤੇ ਰੈਸਟਰੋਂਟਸ ਵਿੱਚ ਜਿਹੜੇ ਟੋਇਲੇਟ ਹੈਗੇ ਉਹਨਾਂ ਦੀ ਸਫਾਈ ਦੀ ਦਿੱਕਤ ਹੁੰਦੀ ਹੈ ਸਰਦੀਆਂ ਵਿੱਚ ਕਈ ਵਾਰੀ ਧੁੰਦ ਹੁੰਦੀ ਹੈ ਬਰਫ਼ ਪੈ ਜਾਂਦੀ ਹੈ ਜਿਸ ਕਰਕੇ ਰਸਤੇ ਬੰਦ ਹੋ ਜਾਂਦੇ ਨੇ ਬਾਰਿਸ਼ਾਂ ਵਿੱਚ ਲੈਂਡਸਲਾਈਡ ਹੋਣ ਕਰਕੇ ਕਈ ਵਾਰੀ ਜਾਮ ਲੱਗ ਜਾਂਦੇ ਨੇ ਬਸੰਤ ਵਿੱਚ ਇਹ ਸਾਰੀਆਂ ਦਿੱਕਤਾਂ ਸਾਨੂੰ ਨਹੀਂ ਆਉਂਦੀਆਂ ਨੇ ਬਸੰਤ ਦੇ ਮੌਸਮ ਵਿੱਚ ਬੰਦਾ ਆਰਾਮ ਨਾਲ ਆਪਣੇ ਯਾਤਰਾ ਦਾ ਆਨੰਦ ਲੈ ਸਕਦਾ ਹੈ ਅਤੇ ਮੌਸਮ ਦੀ ਖੂਬਸੂਰਤੀ ਵਿੱਚ ਨਜ਼ਾਰੇ ਦੇਖ ਸਕਦਾ ਹੈ